ਹਾਂਜੀ ਇੱਕ ਕਲਾਕਾਰ ਦੇ ਰੂਪ ਵਿੱਚ ਮੈਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸਭ ਤੋਂ ਪਹਿਲਾਂ ਮੈਂ ਇੱਕ ਪਿੰਡ ਵਿੱਚ ਰਹਿੰਦੀ ਹਾਂ ਜਿੱਥੇ ਕਿ ਬਹੁਤ ਘੱਟ ਦੁਕਾਨਾਂ ਹਨ ਅਤੇ ਜੋ ਹਨ ਉਹ ਸਿਰਫ ਕਰਿਆਨੇ ਦਾ ਸਮਾਨ ਜਾਂ ਜੋ ਡੇਲੀ ਲੋੜਾਂ ਪੂਰੀਆਂ ਕਰਦਾ ਹੈ ਉਹੀ ਰੱਖਦੇ ਹਨ ਇੱਥੋਂ ਤੱਕ ਕਿ ਮੇਰੇ ਪਿੰਡ ਵਿੱਚ ਕਈ ਵਾਰ ਤਾਂ ਪੈੱਨ ਅਤੇ ਪੈੱਨਸਿਲ ਵੀ ਨਹੀਂ ਮਿਲਦਾ ਸੋ ਮੈਂ ਇਸ ਆਪਣੀ ਚੁਣੌਤੀ ਨੂੰ ਮੁਸ਼ਕਿਲ ਨੂੰ ਦੂਰ ਕਰਨ ਲਈ ਆਪਣਾ ਸਮਾਨ ਪਹਿਲਾਂ ਹੀ ਇਕੱਠਾ ਕਰ ਕੇ ਰੱਖ ਲੈਂਦੀ ਹਾਂ ਅਤੇ ਜੋ ਨਹੀਂ ਮਿਲਦਾ ਉਸ ਨੂੰ ਔਨਲਾਈਨ ਔਡਰ ਕਰ ਕੇ ਵੀ ਮੰਗਵਾ ਲੈਂਦੀ ਹਾਂ ਅਤੇ ਕਈ ਵਾਰ ਮੈਂ ਬਹੁਤ ਸਾਰੀਆਂ ਸਾਰੇ ਲੋਕਾਂ ਤੋਂ ਪ੍ਰੇਰਨਾ ਅਤੇ ਸਹਾਇਤਾ ਲੈਂਦੀ ਹਾਂ ਤਾਂ ਜੋ ਮੈਂ ਆਪਣੀ ਕਲਾ ਨੂੰ ਹੋਰ ਚੰਗੀ ਤਰ੍ਹਾਂ ਨਿਖਾਰ ਸਕਾਂ ਅਤੇ ਇਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਾਂ